ਮੈਨੂੰ ਮੱਝਾਂ ਗਾਵਾਂ ਰੱਖਣੀਆਂ ਬਹੁਤ ਪਸੰਦ ਹਨ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈਗਾ ਅਤੇ ਜਦੋਂ ਵੀ ਸਾਡੇ ਘਰ ਜਾਂ ਮੱਝ ਜਾਂ ਗਾਂ ਸੂੰਦੀ ਆ ਤਾਂ ਉਹਦੇ ਇੱਕ ਨ ਨਵਾਂ ਬੱਚਾ ਸਾਡੇ ਘਰ ਆਉਂਦਾ ਹੈਗਾ ਤਾਂ ਜਿਹੜੀ ਮੱਝ ਦੀ ਡਿਲੀਵਰੀ ਆ ਉਹ ਵੀ ਮੈਂ ਖਾਸ ਆਪ ਦੇ ਹੱਥੀਂ ਹੀ ਕਰਵਾਉਂਦਾ ਹੁੰਦਾ ਅਤੇ ਬਿਲਕੁਲ ਮੈਂ ਆਪਦੀ ਨਿਗਰਾਨੀ ਦੇ ਵਿੱਚ ਕਰਦਾ ਹੈਗਾ ਕਿਉਂਕਿ ਕਈ ਵਾਰ ਜਿਹੜਾ ਕੀ ਆ ਬੱਚੇ ਨੂੰ ਵੀ ਨੁਕਸਾਨ ਹੋ ਸਕਦਾ ਮਦਰ ਨੂੰ ਵੀ ਹੋ ਸਕਦਾ ਕਈ ਵਾਰੀ ਅਣਜਾਣ ਬੰਦਾ ਡੀਲਿਵਰੀ ਸਮੇਂ ਬੱਚੇ ਨੂੰ ਪਹਿਲਿਆਂ 'ਚ ਹੀ ਬਾਹਰ ਖਿੱਚ ਲੈਂਦਾ ਜਾਂ ਇੱਦਾਂ ਦੀਆਂ ਜਾਂ ਬੱਚੇ ਦੇ ਮੂੰਹ ਦੇ ਵਿੱਚ ਪਾਣੀ ਨਹੀਂ ਕੱਢਦਾ ਜਾਂ ਇੱਦਾਂ ਦੀਆਂ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਮੈਂ ਖੁਦ ਆਪ ਕਰਦਾ ਇਹ ਕੰਮ ਅਤੇ ਜਦੋਂ ਜਿਹੜੀ ਮੱਝ ਹੈ ਸੂਅ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਕੀ ਹੈ ਮੈਂ ਉਹਦੇ ਕਟਰੂ ਦੇ ਮੂੰਹ ਦੇ ਵਿੱਚੋਂ ਸਾਰੇ ਜਾਲੇ ਵਗੈਰਾ ਸਾਫ ਕਰਦਾ ਐਂਗਾ ਹੱਥ ਪਾ ਕੇ ਸਾਰੇ ਕੱਢ ਦਈ ਦੇ ਆ ਫਿਰ ਉਹਦੇ ਕੰਨਾਂ ਦੇ ਵਿੱਚ ਫੂਕਾਂ ਮਾਰਦੀ ਮਾਰੀ ਦੀਆਂ ਦੋਨਾਂ ਕੰਨਾਂ ਦੇ ਵਿੱਚ ਫੂਕਾਂ ਮਾਰਦੇ ਹਾਂ ਜੀ ਉਹਦੇ ਅਤੇ ਫਿਰ ਉਦੋਂ ਉਸ ਤੋਂ ਬਾਅਦ ਉਹਨੂੰ ਕੀ ਹੈਗਾ ਇੱਕ ਸੁੱਕੇ ਕੱਪੜੇ ਦੇ ਨਾਲ ਸਾਫ ਵੀ ਕੀਤਾ ਜਾਂਦਾ ਹੈਗਾ ਅਤੇ ਮੱਝ ਉਹਨੂੰ ਚੱਟ ਵੀ ਰਹੀ ਹੁੰਦੀ ਨਾਲ ਨਾਲ ਨਾਲ ਨਾਲ ਉਹਨੂੰ ਕੱਪੜੇ ਦੇ ਨਾਲ ਸਾਫ ਕਰ ਦਿੱਤਾ ਜਾਂਦਾ ਉਹਦੇ ਮੂੰਹ ਦੇ ਵਿੱਚ ਗੁੜ ਪਾ ਗੁੜ ਪਾਇਆ ਜਾਂਦਾ ਤਾਂ ਕਿ ਜਿਹੜਾ ਕਿ ਉਹਦਾ ਚੁੰਘਲ ਹੈ ਵੀ ਉਹਨੇ ਦੁੱਧ ਪੀਣ ਦੇ ਲਈ ਉਹ ਤਿਆਰ ਹੋਜੇ ਉਹ ਇਹਦਾ ਆਪਦਾ ਮੂੰਹ ਮਾਰਨ ਦੇ ਲਈ ਤਿਆਰ ਹੋ ਜਾਂਦਾ ਹੈਗਾ ਹੌਲੀ ਹੌਲੀ ਡੇਢ ਕੁ ਘੰਟੇ ਬਾਅਦ ਉਹ ਖੜ੍ਹਾ ਹੋਣ ਲੱਗ ਜਾਂਦਾ ਹੈਗਾ ਫਿਰ ਉਹ ਫੇਰ ਹੀ ਦੁੱਧ ਪੀਣ ਨੂੰ ਕਰਦਾ ਹੈਗਾ ਤਾਂ ਫਿਰ ਉਹਨੂੰ ਹੌਲੀ ਹੌਲੀ ਉਹਦੇ ਮੂੰਹ 'ਚ ਧਾਰਾਂ ਪਾ ਪਾ ਕੇ ਅਤੇ ਉਹਦੇ ਵਿੱਚ ਥਣ ਪਾ ਪਾ ਕੇ ਹੌਲੀ ਹੌਲੀ ਬਹੁਤ ਹੀ ਔਖੇ ਢੰਗ ਦੇ ਨਾਲ ਟਰਾਈ ਕਰਨਾ ਪੈਂਦਾ ਕਈ ਕੀ ਤਾਂ ਬਹੁਤ ਐਕਟਿਵ ਹੁੰਦੇ ਨੇ ਬੱਚੇ ਉਹ ਆਪਣੇ ਆਪ ਲੱਗ ਜਾਂਦੇ ਨੇ ਬਟ ਕਦੇ ਕਦੇ ਬਹੁਤ ਜ਼ਿਆਦਾ ਔਖਾ ਲੱਗਦਾ ਉਹਨਾਂ ਨੂੰ ਟਰਾਈ ਕਰਵਾਉਣਾ ਕਿਉਂਕਿ ਅਤੇ ਉਹਦੇ ਮੂੰਹ 'ਚ ਕਦੇ ਖੰਡ ਪਾਈ ਦੀ ਹੈ ਕਦੇ ਕੁਛ ਕੀ ਕਰੀਦਾ ਤਾਂ ਉਹਨੂੰ ਲਾ ਲਈਦਾ ਉਸ ਤੋਂ ਬਾਅਦ ਕੀ ਉਹਦਾ ਉਹਦੇ ਜੇ ਸਰਦੀਆਂ ਨੇ ਤਾਂ ਉਹਦੇ ਥੱਲੇ ਸੁੱਕ ਵਿਛਾਉਣੀ ਬੋਰੀ ਦੇਣੀ ਉਹਨੂੰ ਗੁੜ ਪਾਉਣਾ ਅਤੇ ਹੋਰ ਵੀ ਅਤੇ ਦੁੱਧ ਉਹਨੂੰ ਕਿੰਨਾ ਪਿਲਾਉਣਾ ਲੋੜ ਤੋਂ ਵੱਧ ਵੀ ਨਹੀਂ ਪਿਲਾਉਣਾ ਅਤੇ ਘੱਟ ਵੀ ਨਹੀਂ ਪਿਲਾਉਣਾ ਜਿਹੜਾ ਬਉਲਾ ਪੀਂਦਾ ਉਹ ਵੀ ਬਉਲਾ ਉਹਦੇ ਲਈ ਬਹੁਤ ਜ਼ਰੂਰੀ ਹੁੰਦਾ ਹੈਗਾ ਪਹਿਲਾ ਬਉਲਾ ਪੀ ਕੇ ਜਦੋਂ ਪਹਿਲਾ ਉਹ ਪਦਾਰਥ ਬਾਹਰ ਕੱਢਦਾ ਡਾਸਾ ਬੋਲਦੇ ਆ ਉਹਨੂੰ ਆਪਾਂ ਅਤੇ ਉਹ ਬਹੁਤ ਜ਼ਰੂਰੀ ਹੁੰਦਾ ਹੈਗਾ ਵੀ ਜਦੋਂ ਪਹਿਲਾਂ ਦੁੱਧ ਪੀ ਲਿਆ ਡਾਸਾ ਆਉਣਾ ਉਹਦਾ ਬਹੁਤ ਜ਼ਰੂਰੀ ਹੁੰਦਾ ਇਹਨੂੰ ਆਪਾਂ ਦਸ ਪੰਦਰ੍ਹਾਂ ਦਿਨ ਦੇ ਬਾਅਦ ਫਿਰ ਆਪਾਂ ਉਹਦੀ ਡੀਵਾਰਮਿੰਗ ਕਰਨੀ ਹੁੰਦੀ ਹੈ ਕਟਰੂ ਦੀ ਅਤੇ ਉਹਨੂੰ ਕੱਖ ਨਹੀਂ ਪਾਉਣੇ ਹੁੰਦੇ ਕੱਖ ਉਹਨੂੰ ਘੱਟੋ ਘੱਟ ਆਪਾਂ ਮਹੀਨੇ ਤੋਂ ਬਾਅਦ ਹੀ ਉਹਨੂੰ ਪਾਉਣਾ ਆਪਾਂ ਹਰਾ ਚਾਰਾ ਉਸ ਤੋਂ ਪਹਿਲਾਂ ਉਹਨੂੰ ਦੁੱਧ ਦੇ ਨਾਲ ਪੂਰਾ ਰਜਾਉਣਾ ਹੈਗਾ ਤਾਂ ਜਿਹੜਾ ਸਾਡਾ ਕਟਰੂ ਹੈ ਪੂਰਾ ਤੰਦਰੁਸਤ ਰਹਿੰਦਾ